ਪਹਿਲਾਂ ਮੈਨੂੰ ਫੋਟੋਗ੍ਰਾਫੀ ਦਾ ਬਿਲਕੁਲ ਸ਼ੌਕ ਨਹੀਂ ਸੀ ਜਦੋਂ ਤੋਂ ਮੈਨੂੰ ਬੱਚਿਆਂ ਨੇ ਫੋਨ ਲੈ ਕੇ ਦਿੱਤਾ ਤਿੰਨ ਚਾਰ ਸਾਲ ਹੋ ਗਏ ਬੱਚਿਆਂ ਨੇ ਫੋਨ ਲੈ ਕੇ ਦਿੱਤਾ ਅਤੇ ਹੁਣ ਮੈਨੂੰ ਫੋਟੋਆਂ ਕਾਫੀ ਖਿੱਚਣੀਆਂ ਆ ਗਈਆਂ ਕਾਫੀ ਮੈਂ ਤਸਵੀਰਾਂ ਲੈ ਲੈਂਦੀ ਹਾਂ ਅਤੇ ਇਸ ਕਰਕੇ ਅਸੀਂ ਕਾਫੀ ਜਗ੍ਹਾ ਯਾਤਰਾ ਵੀ ਕਰਨ ਜਾਈਦੀ ਤਾਂ ਹੁਣ ਮੇਰਾ ਫੋਨ ਅਲੱਗ ਹੀ ਹੁੰਦਾ ਬੱਚਿਆਂ ਦਾ ਆਪਣਾ ਹੁੰਦਾ ਮੈਂ ਕਾਫੀ ਕਲਿੱਕ ਕਰ ਲੈਂਦੀ ਹਾਂ ਫੋਟੋਆਂ ਅਤੇ ਮੈਂ ਅਸੀਂ ਜਵਾਲਾ ਜੀ ਚਿੰਤਪੁਰਨੀ ਮਾਤਾ ਦੇ ਕਾਫੀ ਫੋਟੋਆਂ ਖਿੱਚੀਆਂ ਮੈਂ ਅਤੇ ਸ਼ਿਮਲੇ ਵੀ ਕਾਫੀ ਘੁੰਮਣ ਗਏ ਅਸੀਂ ਅਤੇ ਉੱਥੇ ਵੀ ਮੈਂ ਫੋਟੋਆਂ ਖਿੱਚੀਆਂ ਅਤੇ ਹੋਰ ਬਹੁਤ ਜ਼ਿਆਦਾ ਐਕਸਪੀਰੀਅੰਸ ਹੁਣ ਹੋ ਗਿਆ ਅਤੇ ਇਸ ਕਰਕੇ ਮਤਲਬ ਪਹਿਲਾਂ ਤਾਂ ਲੋਕ ਕੈਮਰੇ ਲੈ ਕੇ ਜਾਂਦੇ ਹੁੰਦੇ ਸੀਗੇ ਹੁਣ ਕੈਮਰਾ ਨਾਲ ਨਾਲ ਨਹੀਂ ਕੋਈ ਵੀ ਜਲਦੀ ਲੈ ਕੇ ਜਾਂਦਾ ਫੋਨਾਂ ਦੇ ਵਿੱਚ ਹੀ ਕਾਫੀ ਫੋਟੋਆਂ ਖਿੱਚ ਲੈਂਦੇ ਹੈਗੇ ਆ ਫੋਟੋਆਂ ਤਾਂ ਯਾਦਾਸ਼ਤ ਰਹਿੰਦੀ ਹੈਗੀ ਆ ਬੰਦੇ ਦੀ ਜਦੋਂ ਦਿਲ ਕਰੇ ਉਦੋਂ ਫੋਨ ਦੇ ਵਿੱਚੋਂ ਕੱਢ ਕੇ ਦੇਖ ਲਵੋ ਅਤੇ ਪਹਿਲਾਂ ਤਾਂ ਕੈਮਰੇ 'ਚ ਧਵਾਵੋ ਫੋਟੋਆਂ ਆਉਣੀਆਂ ਕਦੋਂ ਆਉਣੀਆਂ ਕਦੋਂ ਨਹੀਂ ਇਹ ਤਾਂ ਹੁਣ ਨਾਲ ਹੀ ਖਿੱਚੋ ਤਾਂ ਨਾਲ ਹੀ ਦੇਖ ਲਵੋ ਬਹੁਤ ਮਤਲਬ ਜ਼ਮਾਨੇ ਦੇ ਨਾਲ ਕਾਫੀ ਜ਼ਿਆਦਾ ਸੁਧਾਰ ਵੀ ਹੋਇਆ ਅਤੇ ਕਈ ਇਹ ਫੋਟੋਆਂ ਦਾ ਗਲਤ ਇਸਤੇਮਾਲ ਵੀ ਕਰ ਲੈਂਦੇ ਹੈਗੇ ਆ ਬੱਚੇ ਅੱਜ ਕੱਲ੍ਹ ਦੇ ਮੁੰਡੇ ਗਲਤ ਕਰ ਲੈਂਦੇ ਹੈਗੇ ਆ ਪਰ ਇੱਦਾਂ ਨਹੀਂ ਕਰਨਾ ਚਾਹੀਦਾ ਫੋਟੋਆਂ ਤਾਂ ਯਾਦਾਸ਼ਤ ਲਈ ਹੁੰਦੀਆਂ ਬੰਦੇ ਦੇ ਲਈ ਚਲੋ ਦੇਖਣ ਵਾਸਤੇ ਕਿਤੇ ਕਿਤੇ ਦੀ ਯਾਦਾਸ਼ਤ ਰਹਿੰਦੀ ਹੈਗੀ ਕਿਤੇ ਗਏ ਆ ਆਪਾਂ ਚਲੋ ਉਦਾਂ ਉੱਥੇ ਦੀਆਂ ਯਾਦਾਂ ਫੋਨਾਂ ਦੇ ਵਿੱਚ ਰਹਿੰਦੀਆਂ ਪਰ ਇਹ ਆ ਵੀ ਗਲਤ ਨਹੀਂ ਇਸਤੇਮਾਲ ਕਰਨਾ ਚਾਹੀਦਾ